ਭੰਗੜਾ ਐਰੋਬਿਕਸ ਇੱਕ ਸ਼ਕਤੀਸ਼ਾਲੀ ਅਤੇ ਮਨੋਰੰਜਕ ਤਰੀਕਾ ਹੈ ਜੋ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਕਰ ਸਕਦਾ ਹੈ ਇਹ ਆਧੁਨਿਕ ਫਿਟਨੈਸ ਅਤੇ ਪਰੰਪਰਾਤਮਕ ਪੰਜਾਬੀ ਨਾਚ ਨੂੰ ਮਿਲ ਕੇ ਬਣਾਇਆ ਗਿਆ ਹੈ ਜੋ ਕਿ ਸਰੀਰਿਕ ਅਤੇ ਮਨ ਦੋਵੇਂ ਲਈ ਫ਼ਾਇਦੇਮੰਦ ਹੈ ਮਾਨਸਿਕ ਸਿਹਤ ਲਈ ਲਾਭ ਤਣਾਓ ਘਟਨਾ ਵਿੱਚ ਮਦਦ ਭੰਗੜੇ ਦੇ ਤੇਜ਼ ਰਿਦਮ ਅਤੇ ਉਤਸ਼ਾਹ ਭਰੇ ਸਟੈਪ ਦਿਮਾਗ ਵਿੱਚ ਐਡੋਫਰਿਨ ਨੂੰ ਵਧਾਉਂਦੇ ਹਨ ਜੋ ਕਿ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਆਤਮ ਵਿਸ਼ਵਾਸ ਵਧਾਉਂਦਾ ਹੈ ਭੰਗੜਾ ਐਰੋਬਿਕਸ ਵਿੱਚ ਮਸ਼ਹੂਰ ਨਾਚ ਹੋਣ ਕਾਰਨ ਵਿਅਕਤੀਆਂ ਨੂੰ ਆਪਣੇ ਆਪ ਤੋਂ ਵਿਸ਼ਵਾਸ ਬਣਾਉਣ ਲਈ ਮਦਦ ਮਿਲਦੀ ਹੈ ਧਿਆਨ ਅਤੇ ਕੇਂਦਰਿਤ ਕਰਨ ਦੀ ਸਮਰਥਾ ਲੈਪਟਾਪ ਜਾਂ ਮੋਬਾਈਲ ਦੀ ਲੰਬੀ ਵਰਤੋਂ ਤੋਂ ਬਾਅਦ ਭੰਗਰਾ ਐਰੋਬਿਕਸ ਮਨ ਨੂੰ ਤਾਜ਼ਗੀ ਪ੍ਰਦਾਨ ਕਰਕੇ ਧਿਆਨ ਰਿਤ ਵਿੱਚ ਕਰਨ ਵਿੱਚ ਮਦਦ ਕਰਦਾ ਹੈ